ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਹਾਂ ਹਾਂਜੀ ਅੱਛਾ ਜੀ ਕਦੋਂ ਆਏ ਹੋ ਜੀ ਅੱਛਾ ਜੀ ਠੀਕ ਹੈ ਤਾਂ ਹੀ ਮੈਂ ਆਖਾਂ ਵੀ ਨਵਾਂ ਨੰਬਰ ਕਿਸ ਦਾ ਹੋ ਸਕਦਾ ਅਤੇ ਨਵਾਂ ਨੰਬਰ ਕਿਸ ਦਾ ਹੋ ਸਕਦਾ ਫਿਰ ਮੈਂ ਠੀਕ ਅੱਛਾ ਜੀ ਹਾਂਜੀ

ਹਾਂਜੀ ਬੇਟਾ ਜੀ ਮੈਂ ਤੁਹਾਨੂੰ ਦੱਸਦੀ ਹਾਂ ਚੱਲੋ ਬਹੁਤ ਬਹੁਤ ਵਧੀਆ ਹੋ ਗਿਆ ਤੁਸੀਂ ਸਾਡੀ ਗਲੀ 'ਚ ਨਵੇਂ ਗੁਆਂਢੀ ਆਏ ਹੋ ਅਤੇ ਕੋਈ ਗੱਲ ਨਹੀਂ ਅਤੇ ਮੈਂ ਤੁਹਾਨੂੰ ਦੱਸਦੀ ਹਾਂ ਬੇਟਾ ਜੀ ਤਾਜ਼ਾ ਫਰੂਟ ਸਬਜ਼ੀਆਂ ਆਪਾਂ ਨੂੰ ਨਾ ਸਬਜ਼ੀ ਮੰਡੀ 'ਚੋਂ ਮਿਲਣਗੀਆਂ ਆਪਣੇ ਇੱਧਰ ਸਬਜ਼ੀ ਮੰਡੀ ਹੈ ਨਾ ਹਾਂਜੀ ਬਾਜ਼ਾਰ ਦੇ ਵਿੱਚ ਲੱਗਦੀ ਹੈ ਉੱਥੇ ਆਪਾਂ ਸੁਬਹਾ ਜਾ ਕੇ ਤਾਜ਼ਾ ਸਬਜ਼ੀ ਫਰੂਟ ਉੱਥੋਂ ਖਰੀਦ ਸਕਦੇ ਹਾਂ ਅਤੇ ਵੈਸੇ ਤਾਂ ਆਪਣੇ ਇੱਥੇ ਤਰਨ ਤਾਰਨ ਗੁਰਦੁਆਰਾ ਸਾਹਿਬ ਦੇ ਕੋਲ ਰੇਹੜੀਆਂ ਲੱਗਦੀਆਂ ਇੱਥੇ ਵੀ ਸਬਜ਼ੀ ਲੱਗਦੀ ਸਬਜ਼ੀ ਮੰਡੀ ਲੱਗਦੀ ਫਰੂਟ ਵੀ ਤਾਜ਼ਾ ਮਿਲ ਜਾਂਦਾ ਸਬਜ਼ੀ ਵੀ ਮਿਲ ਜਾਂਦੀ ਹੈ ਪਰ ਇੰਨਾ ਵੀ ਇੱਥੇ ਥੋੜ੍ਹਾ ਜਿਹਾ ਬੇਟੇ ਮਹਿੰਗਾ ਮਿਲ ਜਾਂਦਾ ਹੈ ਜੀ ਠੀਕ ਹੈ ਜੀ ਅਤੇ ਐਮਰਜੈਂਸੀ ਆਪਾਂ ਲੈਣਾ ਵੀ ਹੋਵੇ ਤਾਂ ਆਪਣੀਆਂ ਗਲੀਆਂ ਦੇ ਵਿੱਚ ਆਪਣੇ ਡੇਲੀ ਆਪਣੀ ਗਲੀ ਦੇ ਵਿੱਚ ਸ਼ਾਮ ਦੇ ਟੇਮ ਸ਼ਾਮ ਨੂੰ ਵੀ ਰੇਹੜੀ ਵਾਲਾ ਆਉਂਦਾ ਸਬਜ਼ੀ ਵਾਲਾ ਅਤੇ ਫਰੂਟ ਵਾਲਾ ਸੁਬਹਾ ਦਸ ਵਜੇ ਵੀ ਤਾਜ਼ੀ ਸਬਜ਼ੀ ਲਿਆਉਂਦਾ ਔਰ ਫਰੂਟ ਲੈ ਕੇ ਆਉਂਦਾ ਹੈਗਾ ਇਹਨੇ ਵੀ ਚੱਲੋ ਕੋਈ ਦੋ ਪੈਸੇ ਕੱਢਣੇ ਹੁੰਦੇ ਆ ਇਹ ਵੀ ਥੋੜ੍ਹਾ ਜਿਹਾ ਦੇ ਜਾਂਦਾ ਹੈ ਆਪਾਂ ਨੂੰ ਜੇ ਆਪਾਂ ਲਗਾਤਾਰ ਸਬਜ਼ੀ ਲਵਾਂਗੇ ਨਾ ਰੈਗੂਲਰ ਫਰੂਟ ਲਵਾਂਗੇ ਸਬਜ਼ੀ ਲਵਾਂਗੇ ਫਿਰ ਅਗਲਾ ਚੱਲੋ ਕੋਈ ਦੋ ਪੈਸੇ ਘੱਟ ਵੀ ਕਰ ਲੈਂਦਾ ਹੈਗਾ ਠੀਕ ਹੈ ਘੱਟ ਰੇਟ 'ਤੇ ਵੀ ਦੇ ਜਾਂਦਾ ਅਤੇ ਇੱਥੇ ਵੈਸੇ ਆਪਾਂ ਨੂੰ ਸਬਜ਼ੀ ਅਤੇ ਫਰੂਟ ਜੇ ਮੰਡੀ 'ਚ ਚੱਲ ਵੜੀਏ ਸੁਬਹਾ ਦੇ ਟੈਮ ਜਾਂਦੇ ਸੀਗੇ ਉੱਥੇ ਆਪਾਂ ਨੂੰ ਬਹੁਤ ਹੀ ਵਧੀਆ ਮਤਲਬ ਕਿ ਲੈਸ ਭਾਅ 'ਤੇ ਮਿਲ ਸਕਦਾ ਹੈਗਾ ਇੱਥੇ ਤਾਂ ਫਿਰ ਤੁਹਾਨੂੰ ਪਤਾ ਅਗਲੇ ਨੇ ਰੇਹੜੀ 'ਤੇ ਵੀ ਲਿਆਉਣਾ ਲਿਆ ਕੇ ਰੇਹੜੀਆਂ 'ਤੇ ਲਾਉਣਾ ਇਸ ਤਰ੍ਹਾਂ ਕਰਕੇ ਅਗਲਾ ਕੁ ਚਾਰ ਪੈਸੇ ਵੱਧ ਹੀ ਲਾਉਂਦਾ ਬੇਟਾ ਜੀ ਹਾਂਜੀ ਅਤੇ ਉਹ ਹਾਂਜੀ ਬੇਟਾ ਜੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਨਾ ਇੱਕ ਅੱਧੇ ਦਿਨ ਦੇ ਵਿੱਚ ਚਾਹ ਪਾਣੀ ਵਾਸਤੇ ਘਰ ਬੁਲਾਉਂਦੇ ਹਾਂ ਤੁਸੀਂ ਸਾਡੇ ਘਰ ਆਓ ਚਾਹ ਪਾਣੀ ਪੀਓ ਔਰ ਮੈਂ ਤੁਹਾਨੂੰ ਨਾਲ ਲੈ ਕੇ ਚੱਲੂੰਗੀ ਮੈਂ ਤੁਹਾਡੇ ਨਾਲ ਘਰ ਉੱਥੇ ਚੱਲੂਗੀ ਸਬਜ਼ੀ ਮੰਡੀ ਦੇ ਵਿੱਚ ਠੀਕ ਹੈ ਸਬਜ਼ੀ ਮੰਡੀ 'ਚ ਚੱਲੂੰਗੀ ਅਤੇ ਮੈਂ ਤੁਹਾਡੇ ਨਾਲ ਜਿੱਥੋਂ ਅਸੀਂ ਸਬਜ਼ੀ ਖਰੀਦਦੇ ਹਾਂ ਉੱਥੇ ਸਹੀ ਰੇਟ 'ਤੇ ਤੁਹਾਨੂੰ ਸਬਜ਼ੀ ਦਵਾ ਦੂੰਗੀ ਜਿੰਨੀ ਤੁਸੀਂ ਲੈਣੀ ਹੋਈ ਠੀਕ ਹੈ ਜਿਹੜੀਆਂ ਜਿਹੜੀਆਂ ਮਤਲਬ ਸਬਜ਼ੀਆਂ ਦੋ ਚਾਰ ਸਬਜ਼ੀਆਂ ਇਕੱਠੀਆਂ ਹੀ ਲੈ ਲਓ ਜੀ ਠੀਕ ਹੈ ਦੋ ਚਾਰ ਸਬਜ਼ੀਆਂ ਇਕੱਠੀਆਂ ਲੈ ਲਓ ਜੀ ਕੋਈ ਘੱਟ ਲੈਸ ਰੇਟ 'ਤੇ ਮਿਲ ਜਾਣੀ ਆ ਫਰੂਟ ਲੈ ਲਓ ਜੇ ਬੱਚਿਆਂ ਵਾਸਤੇ ਦੋ ਚਾਰ ਠੀਕ ਹੈ ਅਤੇ ਉਹਦੇ ਨਾਲ ਇੰਨਾ ਵੀ ਤੁਹਾਡਾ ਕੋਈ ਚਾਰ ਪੰਜ ਦਿਨ ਨਿਕਲ ਜਾਣਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਮਤਲਬ ਜੇ ਉਹ ਆਪਾਂ ਨੂੰ ਵਰਤਨਾ ਕਰਨਾ ਆਪਣੀ ਗਲੀ 'ਚ ਰੇਹੜੀ ਆਉਂਦੀ ਹੈ ਅਤੇ ਆਪਾਂ ਨੂੰ ਲੋੜ ਪਈ ਐਮਰਜੈਂਸੀ ਲੋੜ ਵੀ ਪੈ ਜਾਂਦੀ ਹੈ ਚੱਲ ਕਈ ਵਾਰੀ ਖ਼ਤਮ ਹੋ ਜਾਂਦੀ ਹੈ ਕਈ ਵਾਰੀ ਗੈਸਟ ਆ ਜਾਂਦੇ ਨੇ ਘਰ ਉਹਨਾਂ ਵਾਸਤੇ ਸਬਜ਼ੀ ਭਾਜੀ ਤਾਜ਼ੀ ਬਣਾਉਣੀ ਹੁੰਦੀ ਹੈ ਤਾਂ ਆਪਾਂ ਇੱਥੇ ਰੇਹੜੀ ਵਾਲੇ ਤੋਂ ਵੀ ਲੈ ਸਕਦੇ ਹਾਂ ਬੇਟੇ ਠੀਕ ਹੈ ਬੇਟਾ ਜੀ ਹਾਂਜੀ ਠੀਕ ਹੈ ਬੇਟਾ ਜੀ ਓਕੇ ਬੇਟਾ ਜੀ ਕੋਈ ਗੱਲ ਨਹੀਂ ਠੀਕ ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਠੀਕ ਹੈ ਬੇਟਾ ਜੀ ਸਤਿ ਸ਼੍ਰੀ ਅਕਾਲ